ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਡੇ ਇੱਥੇ ਸਿੱਖ ਧਰਮ ਵਿੱਚ ਦਸ ਗੁਰੂ ਸਾਹਿਬਾਨ ਸਨ ਅਤੇ ਜਿਹੜੇ ਪਹਿਲੇ ਗੁਰੂ ਸੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਸਾਢੇ ਪੰਜ ਸੌ ਸਾਲ ਪਹਿਲਾਂ ਇੱਕ ਪ੍ਰਥਾ ਸ਼ੁਰੂ ਕੀਤੀ ਨਾਮ ਜਪੋ ਵੰਡ ਛਕੋ ਅਤੇ ਕਿਰਤ ਕਰੋ ਅਤੇ ਫਿਰ ਉਹਨਾਂ ਨੇ ਜਿਹੜਾ ਹੀ ਆਪਣੇ ਸਿੱਖ ਧਰਮ ਨੂੰ ਅੱਗੇ ਵੀ ਵਧਾਇਆ ਉਹਨਾਂ ਨੇ ਸੱਚਾ ਸੌਦਾ ਕੀਤਾ ਸੀ ਅਤੇ ਉਹਨਾਂ ਨੇ ਤੇਰਾ ਤੇਰਾ ਕਰਕੇ ਸਾਰਿਆਂ ਨੂੰ ਜਿਹੜਾ ਸੀ ਅਨਾਜ ਵੰਡਿਆ ਸੀ ਅਤੇ ਉਸ ਤੋਂ ਬਾਅਦ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਸੀ ਉਹਨਾਂ ਨੇ ਅੰਮ੍ਰਿਤ ਛਕਾਇਆ ਸੀ ਅਤੇ ਪੰਜ ਪਿਆਰਿਆਂ ਨੂੰ ਜਿਹੜਾ ਇਹ ਅੰਮ੍ਰਿਤ ਛਕਾਇਆ ਸੀ ਫਿਰ ਇੱਥੇ ਏ ਲੰਗਰ ਦੀ ਪ੍ਰਥਾ ਵੀ ਚਲਦੀ ਪਈ ਹੈ ਸਾਡੇ ਇੱਥੇ ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਹੈ ਅਤੇ ਇਥੋਂ ਦਾ ਮੁੱਖ ਪ੍ਰਸਿੱਧ ਜਿਹੜਾ ਵਾ ਉਹ ਗੁਰਦੁਆਰਾ ਗੁਰਦੁਆਰਾ ਸਾਹਿਬ ਆ ਹਰਿਮੰਦਰ ਸਾਹਿਬ ਅਤੇ ਇੱਥੇ ਬਾਹਰੋਂ ਬੜੀ ਦੂਰੋਂ ਦੂਰੋਂ ਵਿਛ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਨੇ ਇੱਥੇ ਆ ਕੇ ਅਤੇ ਇੱਥੇ ਚੌਵੀ ਘੰਟੇ ਜਿਹੜਾ ਵਾ ਉਹ ਕੀਰਤਨ ਚੱਲਦਾ ਹੀ ਰਹਿੰਦਾ ਵਾ ਲੰਗਰ ਵੀ ਚੌਵੀ ਘੰਟੇ ਚਲਦਾ ਰਹਿੰਦਾ ਅਤੇ ਉਸ ਤੋਂ ਬਾਅਦ ਇੱਥੇ ਹੋਰ ਵੀ ਗੁਰਦੁਆਰੇ ਨੇ ਜਿਵੇਂ ਕਿ ਤਰਨ ਤਾਰਨ ਸਾਹਿਬ ਬਾਬਾ ਬੁੱਢਾ ਸਾਹਿਬ ਅਤੇ ਉੱਥੇ ਵੀ ਚੌਵੀ ਘੰਟੇ ਪਾਠ ਚੱਲਦਾ ਰਹਿੰਦਾ ਹੈ ਅਤੇ ਲੰਗਰ ਵੀ ਹਰ ਗੁਰਦੁਆਰੇ 'ਚ ਲੰਗਰ ਚੱਲਦਾ ਹੈ

ਹਾਂਜੀ ਠੀਕ ਹੈ ਜੀ ਹਾਂਜੀ